ਸਾਡਾ ਪੰਜਾਬ ਰਾਜ ਖੇਤੀਬਾੜੀ 'ਤੇ ਨਿਰਭਰ ਕਰਦਾ ਹੈ ਸਾਡੇ ਬਹੁਤ ਸਾਰੇ ਕਿਸਾਨ ਖੇਤੀਬਾੜੀ ਤੋਂ ਰੁਜ਼ਗਾਰ ਪੈਦਾ ਕਰਦੇ ਹਨ ਕਿਸਾਨ ਆਪਣੀ ਫਸਲ ਬਿਜਾਉਣ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਜਿਵੇਂ ਕਿ ਵਿੱਤੀ ਸਹਾਇਤਾ ਜਾਂ ਔਜ਼ਾਰਾਂ ਦੀ ਕਮੀ ਚੰਗੀ ਕੁਆਲਿਟੀ ਵਾਲੇ ਬੀਜਾਂ ਦੀ ਕਮੀ ਬਿਜਲੀ ਦੀ ਕਮੀ ਜਦੋਂ ਕਿ ਕਿਸਾਨ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸਦੀ ਕਟਾਈ ਕਰਕੇ ਪੈਦਾਵਾਰ ਨੂੰ ਵੇਚਣ ਵਾਸਤੇ ਅਸੀਂ ਮੰਡੀਆਂ ਵਿੱਚ ਲੈ ਕੇ ਜਾਂਦੇ ਹਾਂ ਪਹਿਲਾਂ ਤਾਂ ਸਾਨੂੰ ਆਪਣੀ ਪੈਦਾਵਾਰ ਨੂੰ ਮੰਡੀ ਵਿੱਚ ਵੇਚਣ ਲਈ ਘੰਟੇ ਜਾਂ ਦਿਨਾਂ ਕਈ ਦਿਨਾਂ ਲਈ ਇੰਤਜ਼ਾਰ ਕਰਨਾ ਪੈਂਦਾ ਹੈ ਜੇਕਰ ਮੀਂਹ ਜਾਂ ਹਨੇਰੀ ਆ ਜਾਵੇ ਤਾਂ ਸਾਡੀ ਸਾਰੀ ਫਸਲ ਮੰਡੀਆਂ ਵਿੱਚ ਹੀ ਰੁਲਦੀ ਰਹਿੰਦੀ ਹੈ ਸਾਡੀਆਂ ਫਸਲਾਂ ਦਾ ਸਹੀ ਰੇਟ ਨਹੀਂ ਲੱਗਦਾ ਇਸ ਵਿੱਚ ਵਿਚੋਲੀਆ ਹੁੰਦਾ ਹੈ ਜੋ ਕਿ ਆਪਣਾ ਅਤੇ ਸਰਕਾਰ ਦਾ ਮੁਨਾਫਾ ਕੱਢਦਾ ਹੈ ਐਮ ਐਸ ਪੀ ਲਾਗੂ ਕਰਨੀ ਚਾਹੀਦੀ ਹੈ ਸਾਡੇ ਬਹੁਤ ਸਾਰੇ ਕਿਸਾਨ ਧਰਨੇ ਲਗਾ ਕੇ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ